ਬਹੁਤ ਸਾਰੀਆਂ ਐਪਸ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ ਅਸੀਂ ਇਹਨਾਂ ਐਪਸ ਤੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਮੇਰੇ ਰੋਜ਼ਾਨਾ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਗੂਗਲ ਪੇ ਜੋ ਕਿ ਮੈਂ ਬਹੁਤ ਹੀ ਜ਼ਿਆਦਾ ਯੂਜ਼ ਕਰਦੀ ਹਾਂ ਇਸ ਨਾਲ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਦੇ ਨਾਲ ਬਹੁਤ ਜ਼ਿਆਦਾ ਪੈਸਿਆਂ ਦੀ ਟਰਾਂਜੈਕਸ਼ਨ ਕਰ ਸਕਦੇ ਹਾਂ ਅਤੇ ਇਸ ਨਾਲ ਸਾਨੂੰ ਕਿਤੇ ਵੀ ਹੋਰ ਜ਼ਿਆਦਾ ਪੈਸੇ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪੈ ਸਕਦੀ ਇਸ ਨਾਲ ਆਪਾਂ ਔਨਲਾਈਨ ਸ਼ੋਪਿੰਗ ਕਰ ਸਕਦੇ ਹਾਂ ਇਸ ਨਾਲ ਆਪਾਂ ਕਿਤੇ ਬਾਹਰ ਜਾ ਕੇ ਵੀ ਕੁਛ ਵੀ ਕਿਤੇ ਵੀ ਬਿੱਲ ਪੇ ਕਰ ਸਕਦੇ ਆਂ ਅਤੇ ਹੋਰ ਕੋਈ ਐਪਸ ਜਿਵੇਂ ਕਿ ਯੂਟੀਊਬ ਯੂਟੀਊਬ ਦੇ ਨਾਲ ਅਸੀਂ ਬਹੁਤ ਕੁਛ ਸਿੱਖ ਸਕਦੇ ਹਾਂ ਇਸ ਨਾਲ ਅਸੀਂ ਨਵੇਂ ਨਵੇਂ ਅ ਖਾਣਾ ਬਣਾਉਣਾ ਨਵਾਂ ਕੁਝ ਸਿੱਖਣਾ ਜੋ ਵੀ ਅਸੀਂ ਆਪਣੇ ਜੀਵਨ ਵਿੱਚ ਚਾਹੁੰਦੇ ਹਾਂ ਉਹ ਸਭ ਕੁਛ ਅਸੀਂ ਯੂਟੀਊਬ ਤੋਂ ਵੀਡੀਓਸ ਦੇਖ ਕੇ ਸਿੱਖ ਸਕਦੇ ਹਾਂ ਅਤੇ ਕੁਛ ਪੜ੍ਹਨਾ ਚਾਹੁੰਦੇ ਹਾਂ ਤਾਂ ਅਸੀਂ ਉਹ ਵੀ ਪੜ੍ਹ ਸਕਦੇ ਹਾਂ ਅਤੇ ਹੋਰ ਐਪਸ ਜਿਵੇਂ ਕਿ ਕਰੋਮ ਕਰੋਮ ਤੋਂ ਅਸੀਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਇਸ ਨਾਲ ਆਪਾਂ ਅਸੀਂ ਇੱਥੇ ਬੈਠੇ ਹੋਏ ਬਹੁਤ ਦੂਰ ਦੇਸ਼ ਦੁਨੀਆ ਦੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਾਂ ਇਸ ਨਾਲ ਅਸੀਂ ਬਹੁਤ ਜ਼ਿਆਦਾ ਆਪਣੀ ਨੌਲੇਜ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਇਹਨਾਂ ਹੋਰ ਐਪਸ ਜਿਵੇਂ ਕਿ ਵਟਸਐਪ ਵਟਸਐਪ ਨਵੇਂ ਨਾਲ ਅਸੀਂ ਇੱਕ ਜਗ੍ਹਾ 'ਤੇ ਬੈਠੇ ਹੋਏ ਦੂਜੇ ਬੰਦੇ ਦੇ ਨਾਲ ਵੀਡੀਓ ਕੋਲ 'ਤੇ ਮੈਸਿਜ਼ ਦੇ ਰਾਹੀਂ ਗੱਲਬਾਤ ਕਰ ਸਕਦੇ ਹਾਂ ਇਸ ਨਾਲ ਅਸੀਂ ਉਹਨਾਂ ਆਪਣੀ ਕਮਿਊਨੀਕੇਸ਼ਨ ਵਧਾ ਸਕਦੇ ਹਾਂ ਤੇ ਤਾਂ ਕਿ ਸਾਡਾ ਮੇਲ ਮਿਲਾਪ ਬਣਿਆ ਰਹੇ ਧੰਨਵਾਦ